ਹੈਲੋ ਹਾਂਜੀ ਸਰ ਗੁਡ ਆਫਟਰਨੂਨ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਸਰ ਹਾਂਜੀ ਹਾਂਜੀ ਸਰ ਜ਼ਰੂਰ ਜੀ ਜ਼ਰੂਰ ਤੁਸੀਂ ਪਹਿਲਾਂ ਇਵੇਂ ਦੱਸੋ ਤੁਸੀਂ ਕਰੀ ਕਿੱਥੋਂ ਤੋਂ ਹੈ ਐਮ ਐਸ ਸੀ ਆਪਣੀ ਅੱਛਾ ਕਿਹੜੇ ਕੋਲਜ 'ਚੋਂ ਕਰੀ ਆ ਜੀ ਅੱਛਾ ਕਿਹੜੇ ਸੈਕਟਰ 'ਚ ਪੈਂਦੇ ਆ ਅੱਛਾ ਤੁਸੀਂ ਹੁਣੀ ਪਾਸ ਆਊਟ ਹੋਏ ਹੋ ਜੀ ਅਤੇ ਪਾਸ ਆਊਟ ਕਦੋਂ ਹੋਏ ਜੀ ਠੀਕ ਹੈ ਜੀ ਤੁਸੀਂ ਉੱਥੇ ਉੱਥੇ ਤੁਹਾਡੇ ਕੋਲ ਪਹਿਲਾਂ ਆਈਆਂ ਸੀਗੀਆਂ ਉੱਥੇ ਪਲੇਸਮੈਂਟ ਵਗੈਰਾ ਕੰਪਨੀ ਵਗੈਰਾ ਉੱਥੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਜੀ ਆਪਾਂ ਤੁਹਾਡੀ ਕਰਵਾ ਦਾਂਗੇ ਦੇਖੋ ਚਾਰ ਵੈਸੇ ਤਾਂ ਕਾਫੀ ਸਾਰੇ ਹੁੰਦੇ ਨੇ ਪਾਸ ਵੀ ਤੁਸੀਂ ਕਿਹੜੀ ਕਿੱਧਰ ਕਿੱਧਰ ਤੁਹਾਡੀ ਚੋਇਸ 'ਤੇ ਵੀ ਤੁਸੀਂ ਕਿਸ ਫੀਲਡ 'ਚ ਜਾਣਾ ਚਾਹੂੰਗਾ ਠੀਕ ਹੈ ਜੀ ਹੁਣ ਪਹਿਲੀ ਤਾਂ ਸਿੰਪਲ ਜਿਹੀ ਗੱਲ ਹੈ ਕਿ ਤੁਹਾਨੂੰ ਪਤਾ ਕਿ ਐਮ ਆਰ ਦੀ ਜੋਬ ਹੁੰਦੀ ਹੈ ਜਿਵੇਂ ਸ਼ੀਪਲਾ ਹੋ ਗਈ ਠੀਕ ਹੈ ਡਾਕਟਰ ਰੈਡੀ ਦੀ ਕੰਪਨੀ ਹੋ ਗਈ ਤਾਂ ਇਹਨਾਂ ਦੇ ਵਿੱਚ ਸਭ ਤੋਂ ਵਧੀਆ ਪੋਸਟ ਹੁੰਦੀ ਹੈਗੀ ਐਮ ਆਰ ਦੀ ਤੁਸੀਂ ਕਿਆ ਕਰਨਾ ਹੋਸਪਿਟਲ 'ਚ ਜਾ ਕੇ ਉਹਨਾਂ ਦਾ ਜਿਹੜਾ ਟਾਰਗੇਟ ਬੇਸਡ ਹੁੰਦੀਆਂ ਨੇ ਇਹ ਜੋ ਵੀ ਮੈਡੀਸਿਨਸ ਨੇ ਉਹਨਾਂ ਦਾ ਪੂਰਾ ਟਾਰਗੇਟ ਪੂਰਾ ਕਰਨਾ ਹੁੰਦਾ ਜਿੰਨਾ ਵੀ ਦੋ ਲੱਖ ਦਾ ਤਿੰਨ ਲੱਖ ਦਾ ਹਫਤੇ ਦਾ ਹੁੰਦਾ ਟਾਰਗੇਟ ਉਹਨਾਂ ਦਾ ਉਸ ਟਾਰਗੇਟ ਨੂੰ ਅਚੀਵ ਕਰਨਾ ਹੁੰਦਾ ਅਤੇ ਉਹ 'ਚ ਸੈਲਰੀ ਵੀ ਅੱਛੀ ਖਾਸੀ ਹੁੰਦੀ ਹੈ ਜੀ ਦੇਖੋ ਲੱਗਦੇ ਸਾਰ ਤੁਹਾਨੂੰ ਤੀਹ ਚਾਲੀ ਹਜ਼ਾਰ ਸਮਥਿੰਗ ਸ਼ੁਰੂ ਹੋ ਜਾਂਦਾ ਅਤੇ ਇਨਕਰੀਮੈਂਟ ਵੀ ਮਿਲਦੇ ਨੇ ਇਹਨਾਂ 'ਚ ਠੀਕ ਹੈ ਜੀ ਅਤੇ ਇਨਕਰੀਮੈਂਟ ਵੀ ਮਿਲਦੇ ਜਿਵੇਂ ਤੁ ਜਿੰਨਾ ਤੁਸੀਂ ਵਧੀਆ ਆਪਣਾ ਕਰੋਗੇ ਸ਼ੋਅ ਉਹਨਾਂ ਨੂੰ ਵਧੀਆ ਆਪਣੀ ਜੋਬ ਕਰੋਗੇ ਇਨਕਰੀਮੈਂਟ ਵੀ ਮਿਲਦੇ ਨੇ ਪਲੱਸ ਤੁਹਾਡੇ ਬਾਹਰ ਦੇ ਟਰਿਪ ਵੀ ਔਰਗਨਾਈਜ਼ ਕਰਦੇ ਨੇ ਠੀਕ ਹੈ ਸਰ ਇਸ ਤੋਂ ਇਲਾਵਾ ਇਹ ਤਾਂ ਮੇਰੇ ਮੈਨੂੰ ਜਿਹੜੀ ਮੈਂ ਚਾਹੁੰਦਾ ਕਿ ਤੁਸੀਂ ਜਾਓ ਤੁਸੀਂ ਆਹ ਮੇਰੇ ਲਈ ਬੈਸਟ ਫੀਲਡ ਹੈ ਇਸ ਤੋਂ ਇਲਾਵਾ ਤੁਸੀਂ ਟੀਚਿੰਗ ਇਸ ਤੋਂ ਇਲਾਵਾ ਤੁਸੀਂ ਟੀਚਿੰਗ 'ਚ ਵੀ ਜਾ ਸਕਦੇ ਹੋ ਸਰ ਟੀਚਿੰਗ ਦੇ ਵਿੱਚ ਤੁਹਾਨੂੰ ਪਤਾ ਚੰਡੀਗੜ੍ਹ ਦੇ ਵਿੱਚ ਹੈਲਿਕਸ ਹੋ ਗਿਆ ਜਾਂ ਆਕਾਸ਼ ਹੋ ਗਿਆ ਐਲਨ ਹੋ ਗਿਆ ਇਹੋ ਜਿਹੇ ਇੰਸਟੀਟਿਊਟ ਨੂੰ ਵਧੀਆ ਟੀਚਰ ਦੀ ਰਿਕੁਾਇਰਮੈਂਟ ਹੁੰਦੀ ਹੈ ਠੀਕ ਹੈ ਇਹਨਾਂ ਨੂੰ ਜਿਹੜਾ ਕਿ ਨੀਟ ਵਗੈਰਾ ਜਾਂ ਫਿਰ ਜੇ ਈ ਮੇਨਜ ਵਗੈਰਾ ਦੀ ਤਿਆਰੀ ਕਰਵਾ ਸਕੇ ਬੱਚਿਆਂ ਨੂੰ ਬਸ ਉਹ ਹੈ ਕਿ ਉਹ ਇੱਕ ਟੈਸਟ ਲੈਂਦੇ ਨੇ ਉਹ ਕੁਆਲੀਫਾਈ ਕਰਨਾ ਪੈਂਦਾ ਤੁਹਾਨੂੰ ਪਹਿਲਾਂ ਜੇ ਤੁਸੀਂ ਉਹ ਕੁਆਲੀਫਾਈ ਕਰਦੇ ਹੋ ਤਾਂ ਤੁਹਾਡੀ ਉਹਦੇ ਵਿੱਚ ਵੀ ਅੱਛੀ ਗਰੋਥ ਹੈ ਦੇਖੋ ਉਹ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਐਜੂਕੇਸ਼ਨ ਦਾ ਜ਼ਮਾਨਾ ਅਤੇ ਪੇਰੈਂਟ ਐਜੂਕੇਸ਼ਨ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੁੰਦੇ ਨੇ ਤਾਂ ਤੁਸੀਂ ਮੈਨੂੰ ਲੱਗਦਾ ਕਿ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਤੁਹਾਡੇ ਮਾਰਕਸ ਕਿੰਨੇ ਜੀ ਐਮ ਐਸ ਸੀ 'ਚ ਠੀਕ ਹੈ ਬਸ ਵਧੀਆ ਸਿਕਸਟੀ ਤੋਂ ਉੱਪਰ ਹੋਣੇ ਚਾਹੀਦੇ ਨੇ ਸਿਕਸਟੀ ਪਲੱਸ ਤੋਂ ਬਾਕੀ ਤੁਹਾਡੇ ਹੈਗੇ ਨੇ ਤੁਸੀਂ ਕਰ ਸਕਦੇ ਹੋ ਉਹਦੇ ਵੀ ਦੇਖ ਸਕਦੇ ਹੋ ਕਰੋ ਵੀ ਦੋ ਹੀ ਆਪਣੇ ਕੋਲ ਮੇਰੇ ਚੋਇਸ ਨਾਲ ਤਾਂ ਇਹ ਦੋ ਹੀ ਨੇ ਬਾਕੀ ਇੰਡਸਟਰੀਅਲ ਏਰੀਅ ਇੰਡਸਟਰੀਅਲ ਏਰੀਆ ਦੇ ਵਿੱਚ ਵੀ ਹੁੰਦੀ ਹੈ ਬੱਦੀ ਸਾਈਡ ਬਟ ਮੈਂ ਤੁਹਾਨੂੰ ਸਜੈਸਟ ਨਹੀਂ ਕਰੂੰਗਾ ਕਿਉਂਕਿ ਤੁਸੀਂ ਐਮ ਐਸ ਸੀ ਕਰੀ ਵੀ ਹੈ ਜੇ ਤੁਸੀਂ ਗ੍ਰੈਜੂਏਟ ਹੁੰਦੇ ਤਾਂ ਮੈਂ ਵੀ ਤੁਹਾਨੂੰ ਸਜੈਸਟ ਕਰ ਦਿੰਦਾ ਐਮ ਐਸ ਸੀ ਵਾਲੇ ਬੰਦੇ ਨੂੰ ਤਾਂ ਇਹ ਵਧੀਆ ਪੋਸਟਾਂ ਹੀ ਕਰਨੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਤੁਸੀਂ ਆਪਣੇ ਥਰੂ ਵੀ ਕਰਵਾ ਦਿੰਦੇ ਆ ਸਰ ਆਪਣੀ ਫੀਸ ਹੁੰਦੀ ਆ ਅਲੱਗ ਤੋਂ ਹਾਂਜੀ ਉਹ ਤੁਹਾਡੀ ਜਦੋਂ ਜੋ ਤੁਹਾਨੂੰ ਜੋਬ ਮਿਲ ਜੂਗੀ ਤੁਹਾਨੂੰ ਆਫਰ ਲੈਟਰ ਆ ਜਾਊਗਾ ਫਿਰ ਅਸੀਂ ਤੁਹਾਡੇ ਤੋਂ ਫੀਸ ਚਾਰਜ ਕਰਦੇ ਹਾਂ ਠੀਕ ਹੈ ਠੀਕ ਹੈ ਸਰ ਓਕੇ ਥੈਂਕ